ਹਾਂਜੀ ਮੈਂ ਪੰਜਾਬ ਵਿੱਚੋਂ ਹਾਂ ਅਤੇ ਮੈਂ ਪੰਜਾਬ ਵਿੱਚ ਭੰਗੜੇ ਨਾਲ ਸੰਬੰਧਿਤ ਗੱਲ ਕਰਦਾਂ ਠੀਕ ਆ ਮੈਂ ਆਪਣੇ ਆਪਣੇ ਜੀਵਨ ਵਿੱਚ ਭੰਗੜਾ ਹੀ ਪਾਇਆ ਹੈ ਠੀਕ ਆ ਤਾਂ ਭੰਗੜਾ ਪਾਉਣ ਦਾ ਅਨੁਭਵ ਬਹੁਤ ਵਧੀਆ ਰਿਹਾ ਠੀਕ ਹੈ ਭੰਗੜਾ ਪਾਉਣ ਨਾਲ ਜਿਹੜੀ ਸਿਹਤ ਹੈ ਉਹ ਬਿਲਕੁਲ ਸੀ ਠੀਕ ਰਹਿੰਦੀ ਆ ਬੰਦੇ ਵਿਅਕਤੀ ਦੇ ਸਰੀਰ ਵਿੱਚ ਜਿਹੜੀ ਫੁਰਤੀਲੀ ਸੰਤੁਸ਼ਟੀ ਅਤੇ ਹੋਰ ਤਰ੍ਹਾਂ ਦੇ ਬਲ ਵੀ ਜ਼ਿਆਦਾ ਆਉਂਦੇ ਹਨ ਠੀਕ ਆ ਭੰਗੜਾ ਪਾਉਣ ਨਾਲ ਜਿਹੜਾ ਦਿਮਾਗ ਆ ਉਹ ਸ਼ਾਰਪ ਹੁੰਦਾ ਹੈ ਜਿਹੜੀ ਮਾਸਪੇਸ਼ੀਆਂ ਏ ਉਹ ਬਹੁਤ ਜ਼ਿਆਦਾ ਲਚਕਦਾਰ ਬਣ ਜਾਂਦੀਆਂ ਹਨ ਜਿਸ ਕਾਰਨ ਵਿਅਕਤੀ ਦੇ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ ਠੀਕ ਹੈ ਤਾਂ ਭੰਗੜਾ ਪਾਉਣ ਨਾਲ ਹੋਰ ਤਰ੍ਹਾਂ ਦੇ ਹੋਰ ਤਰ੍ਹਾਂ ਦੇ ਹੋਰ ਤਰ੍ਹਾਂ ਦੀਆਂ ਜਿਵੇਂ ਐਕਟੀਵਿਟੀਆਂ ਕਹਿ ਲਉ ਜਾਂ ਕੁਛ ਹੋਰ ਤਰੀਕੇ ਦੀਆਂ ਕਹਿ ਲਉ ਉਹਨਾਂ ਵਿੱਚ ਬਹੁਤ ਜ਼ਿਆਦਾ ਹੈਲਪ ਹੈਲਪ ਹੈਲਪ ਕਰਦਾ ਹੈ ਠੀਕ ਹੈ ਭੰਗੜੇ ਵਿੱਚ ਭੰਗੜਾ ਪਾਉਣ ਨਾਲ ਜਿਹੜੀ ਭੰਗੜੇ ਪਾਉਣ ਦੀ ਕਪੈਸ਼ਟੀ ਹੈ ਠੀਕ ਆ ਉਹ ਸਰੀਰ 'ਚ ਹੀ ਹੋਣੀ ਚਾਹੀਦੀ ਹੈ ਜੇਕਰ ਸਰੀਰ 'ਚ ਉਹਦੇ ਨਾਲ ਜ਼ਿਆਦਾ ਕਪੈਸ਼ਟੀ ਹੁੰਦੀ ਹੈ ਠੀਕ ਹੈ ਤਾਂ ਹੀ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਪਾਉਣ ਲਈ ਜਿਹੜਾ ਸਰੀਰ ਹੈ ਉਹਦੀ ਜਿਹੜੀ ਸਮਰੱਥਾ ਏ ਉਹ ਸਮਰੱਥਾ ਕਹਿ ਲਉ ਜਾਂ ਕਹਿ ਲਉ ਕਿ ਐਨਰਜੀ ਆ ਉਹ ਆਪਣੇ ਆਪਣੇ ਉਸ ਉਸ ਮੁਕਾਮ ਤੱਕ ਹੋਣੀ ਚਾਹੀਦੀ ਹੈ ਜਿਸ ਮੁਕਾਮ ਤੱਕ ਆਪਾਂ ਭੰਗੜਾ ਪਾ ਸਕਦੇ ਹਾਂ ਠੀਕ ਹੈ ਤਾਂ ਜਿਹੜਾ ਭੰਗੜਾ ਉਹ ਸਾਡੇ ਜਿਹੜੇ ਸ ਸ ਆਪਣੇ ਜਿਹੜਾ ਕਲਚਰ ਆ ਇਹ ਕਲਚਰ ਨਾਲ ਸੰਬੰਧਿਤ ਹੁੰਦਾ ਹੈ ਇਸੇ ਲਈ ਪੰਜਾਬ 'ਚ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਪੰਜਾਬੀਆਂ ਦੀ ਸਿਹਤ ਸਭ ਤੋਂ ਵਧੀਆ ਹੁੰਦੀ ਹੈ ਕਿਉਂਕਿ ਉਹ ਭੰਗੜਾ ਪਾਉਂਦੇ ਹਨ ਇਸ ਵਿੱਚ ਬੈਠਕਾਂ ਜਾਂ ਕਹਿ ਲਉ ਡੰਡ ਵਗੈਰਾ ਵੀ ਆਦਿ ਵੀ ਲਗਾਏ ਜਾਂਦੇ ਹਨ ਜਿਸ ਕਾਰਨ ਉਹਨਾਂ ਦੀ ਸਿਹਤ ਲੈਗਸ ਦੇ ਲੈਗਸ ਦੀ ਐਕਸਾਇਜ ਜਾਂ ਹੋਰ ਤਰ੍ਹਾਂ ਦੀ ਐਕਸਾਇਜਾਂ ਵੀ ਪ੍ਰਫੁੱਲਿਤ ਤੌਰ 'ਤੇ ਵਧੀਆ ਰਹਿੰਦੀਆਂ ਹਨ